ਹੈਲੋ ਹਾਂਜੀ ਕੀ ਮੇਰੀ ਗੱਲ ਇਲੈਕਟ੍ਰੀਸ਼ਨ ਨਾਲ ਹੋ ਰਹੀ ਹੈ ਹਾਂਜੀ ਮੈਮ ਮੈਂ ਆਪਣੇ ਘਰ ਜਿਵੇਂ ਲਾਈਟਾਂ ਲਗਵਾਉਣੀਆਂ ਸੀ ਤੁਸੀਂ ਮੈਨੂੰ ਦੱਸ ਸਕ ਦੱਸ ਸਕਦੇ ਹੋ ਵੀ ਤੁਹਾਡੇ ਕੋਲ ਕਿਹੜੀ ਕਿਹੜੀ ਵਿਰਾਇਟੀਜ ਅਵੇਲੇਬਲ ਹੈਗੀਆਂ ਨੇ ਹਾਂਜੀ

ਜੀ ਇੱਕ ਕਮਰਾ ਤਾਂ ਵੈਸੇ ਡਿਜਾਇਨ ਕਰਵਾਉਣਾ ਅਸੀਂ ਵੀ ਜਿਵੇਂ ਪਾਰਟੀ ਵਗੈਰਾ ਕਰੀਏ ਇੱਕ ਹੋਲ ਦੀ ਤਰ੍ਹਾਂ ਅਤੇ ਉਹਦੇ ਵਿੱਚ ਪਾਰਟੀਜ ਵਾਲੀਆਂ ਲਾਈਟਸ ਹੁੰਦੀਆਂ ਨੇ ਜਾਂ ਆਪਾਂ ਫੈਸਟੀਵਲਜ 'ਤੇ ਜਿਹੜੀਆਂ ਵਰਤਦੇ ਨੇ ਉਹੋ ਜਿਹੀਆਂ ਅਤੇ ਉਨ੍ਹਾਂ ਦਾ ਤੁਸੀਂ ਮੈਨੂੰ ਦੱਸ ਦਿਉ ਓਕੇ ਠੀਕ ਹੈ ਅਤੇ ਇੱਕ ਅਸੀਂ ਸਟੱਡੀ ਰੂਮ ਤਿਆਰ ਕਰਵਾਉਣਾ ਉਹਦੇ ਵਾਸਤੇ ਤੁਸੀਂ ਦੱਸ ਸਕਦੇ ਹੋ ਵੀ ਸਟੱਡੀ ਲੈਂਪ ਜ਼ਿਆਦਾ ਵਧੀਆ ਰਹੇਗਾ ਜਾਂ ਆਪਾਂ ਹੋਲਡਰ ਵਿੱਚ ਟਿਊਬ ਲਾਈਟਸ ਜਾਂ ਬੱਲਬ ਲਗਾਈਏ ਤਾਂ ਕਿਹੋ ਜਿਹੇ ਲਗਵਾਈਏ ਅਤੇ ਇੱਕ ਜੀਰੋ ਵਾਟ ਦੇ ਬੱਲਬ ਆਉਂਦੇ ਹੈ ਕੀ ਤੁਹਾਡੇ ਕੋਲ ਉਹ ਮਿਲ ਜਾਣਗੇ ਤੁਸੀਂ ਮੈਨੂੰ ਇੱਕ ਵਾਰੀ ਤੁਹਾਡਾ ਪ੍ਰਾਈਜ ਦੱਸ ਦਿਉ ਹਾਂਜੀ ਠੀਕ ਹੈ ਅਤੇ ਮੈਨੂੰ ਇਹ ਦੱਸੋ ਵੀ ਤੁਸੀਂ ਆਪ ਆ ਕੇ ਲਗਾ ਕੇ ਜਾਉਗੇ ਜਾਂ ਤੁਹਾਡੀ ਕੰਪਨੀ 'ਚੋਂ ਕੋਈ ਹੋਰ ਆਵੇਗਾ ਜਿਹੜਾ ਤਾਂ ਸਾਡੀ ਸਾਰੀ ਫਿਟਿੰਗ ਕਰਕੇ ਜਾਵੇਗਾ ਘਰ ਦੀ ਅਤੇ ਉਨ੍ਹਾਂ ਦੇ ਕੋਈ ਐਕਸਟਰਾ ਚਾਰਜਸ ਠੀਕ ਹੈ ਜੀ ਕੀ ਤੁਹਾਡੇ ਕੋਲ ਨਿਰੋਲ ਕੰਪਨੀ ਦੇ ਮਿਲ ਸਕਦੇ ਹੈ ਠੀਕ ਹੈ ਜੀ ਓਕੇ ਥੈਂਕ ਯੂ ਮੈਮ